ਹੈਲੋ ਹੋਰ ਯਾਰ ਕੀ ਹਾਲ ਚਾਲ ਹੋਰ ਵਧੀਆ ਠੀਕ ਠਾਕ ਘਰ ਠੀਕ ਠਾਕ ਸਭ ਯਾਰ ਮੈਂ ਤੇਰੇ ਨਾਲ ਬਹੁਤ ਜ਼ਰੂਰੀ ਗੱਲ ਕਰਨੀ ਸੀ ਗੀ ਯਾਰ ਮੇਰਾ ਨਾ ਆਧਾਰ ਕਾਰਡ ਗੁਆਚ ਗਿਆ ਹੈ ਅਤੇ ਮੈਂ ਡੁਬਲੀਕੇਟ ਬਣਵਾਉਣ ਵਾਸਤੇ ਅਰਜ਼ੀ ਦੇਣੀ ਸੀਗੀ ਅਤੇ ਸਾਡੇ ਇੱਥੇ ਕੋਈ ਲਾਗੇ ਸੁਵਿਧਾ ਕੇਂਦਰ ਨਹੀਂ ਹੈਗਾ ਹੈਗਾ ਹੋਵੇਗਾ ਵੀ ਸ਼ਾਇਦ ਵੀ ਮੈਨੂੰ ਇਸ ਬਾਰੇ ਕੋਈ ਨੌਲਜ ਨਹੀਂ ਹੈਗੀ ਹੈਗੀ ਹਾਂਜੀ ਅਤੇ ਮੈਂ ਇਸ ਲਈ ਮੈਂ ਕਿਹਾ ਸੀ ਮੈਂ ਆਪ ਦੇ ਦੋਸਤ ਦੀ ਇੱਕ ਵਾਰੀ ਸਲਾਹ ਲਵਾਂ ਵੀ ਕੀ ਹਿਸਾਬ ਕਿਤਾਬ ਹੈ ਅਤੇ ਜੇ ਤੂੰ ਮੇਰੀ ਮਦਦ ਕਰ ਦਵੇਂ ਤਾਂ ਤੇਰਾ ਬਹੁਤ ਬਹੁਤ ਧੰਨਵਾਦ ਹੋਵੇਗਾ ਤੂੰ ਇੱਥੋਂ ਪਤਾ ਕਰਦੇ ਵੀ ਸ਼ਾਇਦ ਕੋਈ ਤੁਹਾਡੇ ਲਾਗੇ ਹੋਵੇ ਜਿੱਥੋਂ ਮੇਰਾ ਕੰਮ ਬਣ ਸਕੇ ਜੇ ਤੈਨੂੰ ਨਹੀਂ ਪਤਾ ਤਾਂ ਸ਼ਾਇਦ ਵੀ ਕਿਸੇ ਹੋਰ ਦੀ ਮਦਦ ਲੈ ਲਵਾਂ ਮੈਂ ਨੌਕਰੀ ਵਾਸਤੇ ਫਾਰਮ ਭਰਨੇ ਨੇ ਅਤੇ ਉਹਦੇ ਵਿੱਚ ਮੈਨੂੰ ਆਧਾਰ ਕਾਰਡ ਦੀ ਬਹੁਤ ਜ਼ਰੂਰਤ ਹੈ ਅਤੇ ਤੈਨੂੰ ਵੀ ਪਤਾ ਹੀ ਹੈ ਵੀ ਜਦੋਂ ਆਪਾਂ ਫਾਰਮ ਨੌਕਰੀ ਦੇ ਭਰੀਏ ਤਾਂ ਉਹਦੇ ਵਿੱਚ ਆਧਾਰ ਕਾਰਡ ਦੀ ਬਹੁਤ ਜ਼ਰੂਰਤ ਹੁੰਦੀ ਹੈ ਆਧਾਰ ਕਾਰਡ ਤਾਂ ਆਪਣਾ ਵੀ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਹੈ ਅਤੇ ਇਸੇ ਲਈ ਮੈਂ ਕਿਹਾ ਵੀ ਸ਼ਾਇਦ ਮੈਂ ਆਪਣੇ ਦੋਸਤ ਨਾਲ ਸਲਾਹ ਕਰ ਲਵਾਂ ਵੀ ਸ਼ਾਇਦ ਉਹਨਾਂ ਦੇ ਲਾਗੇ ਕੋਈ ਹੋਵੇ ਜੋ ਮੇਰੀ ਮਦਦ ਕਰ ਸਕੇ ਜੇ ਤੂੰ ਮੇਰੀ ਮਦਦ ਕਰ ਦੇਵੇਗਾ ਤਾਂ ਮੈਂ ਤੇਰਾ ਬਹੁਤ ਬਹੁਤ ਧੰਨਵਾਦ ਕਰਾਂਗਾ ਹਾਂਜੀ ਹੋ ਸਕਦਾ ਹੋ ਸਕੇ ਤਾਂ ਕਰ ਦੇਵੇ ਤਾਂ ਬਹੁਤ ਵਧੀਆ ਹੋਵੇਗਾ ਬਹੁਤ ਹੀ ਜ਼ਿਆਦਾ ਤੇਰਾ ਧੰਨਵਾਦ ਕਰਾਂਗਾ ਮੈਂ